ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਫੂਡਜ਼ ਆਈਕਰ ਰੈਸਟੋਰੈਂਟ ਤੋਂ ਬੋਲ ਰਹੇ ਹੋ ਕੀ ਤੁਸੀਂ ਮੈਨੂੰ ਅੱਜ ਦੇ ਵਿਸ਼ੇਸ਼ ਪਕਵਾਨ ਬਾਰੇ ਦੱਸ ਸਕਦੇ ਹੋ ਨਹੀਂ ਜੀ ਮੈਂ ਤਾਂ ਟੇਕਵੇ ਨਹੀਂ ਕਰਨਾ ਔਰ ਨਾ ਹੀ ਡਾਇਨ ਕਰਨਾ ਹੈ ਮੈਂ ਹੋਮ ਮੈਨੂੰ ਹੋਮ ਡਿਲੀਵਰੀ ਚਾਹੀਦੀ ਹੈ ਨਹੀਂ ਨਹੀਂ ਸਾਡਾ ਘਰ ਜ਼ਿਆਦਾ ਦੂਰ ਨਹੀਂ ਹੈ ਅਸੀਂ ਸ਼ਿੰਗਾਰਮ ਨੂੰ ਵਿੱਚ ਰਹਿੰਦੇ ਹਾਂ ਹਾਂਜੀ ਤੁਸੀਂ ਮੈਨੂੰ ਅੱਜ ਦੇ ਕੀ ਵਿਸ਼ੇਸ਼ ਪਕਵਾਨ ਬਾਰੇ ਦੱਸ ਦਿਓ ਅੱਛਾ ਜੀ ਤੁਸੀਂ ਇਸ ਤੋਂ ਇਲਾਵਾ ਹੋਰ ਕੁਛ ਨਹੀਂ ਬਣਾ ਸਕਦੇ ਐਕਚੁਲੀ ਮੈਨੂੰ ਇਟਾਲੀਅਨ ਫੂਡ ਦੇ ਵਿੱਚ ਕੁਛ ਸਪੈਸ਼ਲ ਚੀਜ਼ ਚਾਹੀਦੀ ਸੀ ਅੱਛਾ ਇੱਕ ਤੁਹਾਡੇ ਰੈਸਟੋਰੈਂਟ ਦੀ ਮਸ਼ਹੂਰ ਡਿਸ਼ ਹੈ ਉਹ ਇਟਾਲੀਅਨ ਹੈ ਕੁਛ ਇਟਾਲੀਅਨ ਕਰਕੇ ਹੈ ਉਹ ਮੈਨੂੰ ਉਸਦਾ ਨਾਮ ਨਹੀਂ ਯਾਦ ਆ ਰਿਹਾ ਹਾਂਜੀ ਹਾਂਜੀ ਫੂਡਜ਼ ਆਏਗਾ ਸੰਡੇ ਸਪੈਸ਼ਲ ਇਹ ਕਿਸ ਪ੍ਰਕਾਰ ਦੀ ਡਿਸ਼ ਹੈ ਥੋੜ੍ਹਾ ਮੈਨੂੰ ਇਹਦੇ ਬਾਰੇ ਦੱਸੋ ਅੱਛਾ ਜੀ ਇੱਕ ਬੰਦੇ ਲਈ ਇੱਕ ਪਲੇਟ ਸਫੀਸ਼ੈਂਟ ਹੈ ਓਕੇ ਤੁਸੀਂ ਮੈਨੂੰ ਛੇ ਪਲੇਟ ਭੇਜ ਦਿਓ ਮੈਂ ਪੇਮੈਂਟ ਕੈਸ਼ ਕਰਾਂਗੀ ਮੈਂ ਆਪਣਾ ਘਰ ਦਾ ਪਤਾ ਦੱਸ ਦਿੰਦੀ ਹਾਂ ਹਾਂਜੀ ਨੋਟ ਕਰੋ ਗ੍ਰੈਂਟ ਟ੍ਰੰਕ ਰੋਡ ਓਪੋਜਿਟ ਪੋਸਟ ਔਫਿਸ ਸ਼ਿੰਗਾਰ ਐਵੇਨਿਊ

ਹਾਂਜੀ ਕਿੰਨੇ ਪੇ ਕਿੰਨੇ ਪੈਸੇ ਬਣੇ ਜੀ ਅੱਛਾ ਜੀ ਠੀਕ ਹੈ ਜੀ ਅਗਰ ਫਿਰ ਵੀ ਕੋਈ ਤੁਹਾਨੂੰ ਮੁਸ਼ਕਿਲ ਆਵੇ ਤਾਂ ਤੁਸੀਂ ਮੈਨੂੰ ਮੇਰੇ ਇਸ ਨੰਬਰ 'ਤੇ ਕਾਲ ਕਰ ਲੈਣਾ ਥੈਂਕਯੂ ਹਾਂਜੀ

ਅੱਛਾ ਜੀ ਹਾਂਜੀ ਛੇ ਪਲੇਟ ਸਫੀਸ਼ੈਂਟ ਹਾਂਜੀ ਇਸ ਦੇ ਨਾਲ ਤੁਸੀਂ ਮੈਨੂੰ ਸਪੈਸ਼ਲ ਹੋਰ ਕੀ ਦੇ ਰਹੇ ਹੋ ਅੱਛਾ ਜੀ

ਠੀਕ ਹੈ ਜੀ ਠੀਕ ਹੈ ਜੀ ਤੁਸੀਂ ਮੈਨੂੰ ਛੇ ਪਲੇਟ ਦੇ ਨਾਲ ਛੇ ਕੋਕ ਭੇਜ ਦੇਣਾ ਔਰ ਸਾਥ ਵਿੱਚ ਥੋੜ੍ਹੇ ਫਰੈਂਚ ਫ੍ਰਾਈਜ਼ ਥੋੜ੍ਹਾ ਹਾਂਜੀ ਇਟਾਲੀਅਨ ਪਾਸਤਾ ਹਾਂਜੀ ਤਿੰਨ ਪਲੇਟ ਸ ਪਾਸਤਾ ਭੇਜ ਦਿਉ ਜੀ ਹਾਂਜੀ ਠੀਕ ਹੈ ਜੀ ਓਕੇ ਜੀ ਥੈਂਕ ਯੂ